ਹਾਂ ਅਸੀਂ ਚਾਹੁੰਦੇ ਹਾਂ ਕਿ ਮਤਲਬ ਕਈ ਪਿੰਡਾਂ ਦੇ ਲੋਕਾਂ ਨੂੰ ਔਰਤਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਉਨ੍ਹਾਂ ਲਈ ਕੋਈ ਪੇਪਰ ਜਾਂ ਰੇਡੀਓ ਵਿੱਚ ਕੋਈ ਵਧੀਆ ਵਿਸ਼ੇਸ਼ ਸੈਕਸ਼ਨ ਹੋਣ ਤਾਂ ਪਿੰਡਾਂ ਦੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਔਰਤਾਂ ਨੇ ਕੀ ਕੀ ਕੰਮ ਕੀਤੇ ਨੇ ਕੀ ਕੀ ਜਿਹੜੇ ਉਹ ਹੋਣ ਕੀ ਹੁਣ ਤੱਕ ਪ੍ਰਾਪਤੀਆਂ ਕੀਤੀਆਂ ਨੇ ਕਿੱਥੋਂ ਤੱਕ ਗਈਆਂ ਨੇ ਔਰਤਾਂ ਦੇ ਰਿਲੇਟਡ ਕੋਈ ਖ਼ਾਸ ਮੌਕੇ ਹੈਗੇ ਨੇ ਕੁਛ ਖ਼ਾਸ ਮੈਗਜ਼ੀਨ ਵੀ ਨੇ ਜਿਵੇਂ ਵੁਮੈਨ ਆਲ ਇੰਡੀਆ ਫੈਡਰੇਸ਼ਨ ਅਤੇ ਪੰਜਾਬ ਇਸਤਰੀ ਸਭਾ ਹੋ ਗਈ ਜਾਂ ਆਂਗਨਵਾੜੀ ਵਰਕਰਾਂ ਦੀਆਂ ਸੰਸਥਾਵਾਂ ਅਲੱਗ ਤੋਂ ਹੋ ਗਈਆਂ ਹਨ ਜਿਨ੍ਹਾਂ ਵਿੱਚ ਵੁਮੈਨ ਹੈਗੀਆਂ ਨੇ ਅਤੇ ਉਹ ਆਪਣੀ ਆਵਾਜ਼ ਚੁੱਕਦੀਆਂ ਨੇ ਆਪਣੇ ਉਨ੍ਹਾਂ ਦੇ ਅਲੱਗ ਤੋਂ ਮੈਗਜ਼ੀਨ ਨੇ ਜਾਂ ਕੋਲਮ ਨੇ ਉਸ ਤਰ੍ਹਾਂ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਜਿਹੜੀ ਕੇ ਔਰਤਾਂ ਵਾਸਤੇ ਇੱਕ ਵਿਸ਼ੇਸ਼ ਕੋਲਮ ਬਣਾਏ